ਸਕੂਲ ਤੋਂ ਬਾਅਦ ਸ਼ਾਮ ਦੀ ਟਿਊਸ਼ਨ ਜਾਂ ਪ੍ਰਾਈਵੇਟ ਕਲਾਸਾਂ ਬਾਰੇ ਮੈਂ ਸੋਚਦੀ ਹਾਂ ਕਿ ਇਹ ਬਿਲਕੁਲ ਸਹੀ ਹੈ ਜਿਹੜੇ ਪੇਰੈਂਟਸ ਕੋਲ ਟਾਈਮ ਨਹੀਂ ਹੁੰਦਾ ਆਪਣੇ ਬੱਚੇ ਨੂੰ ਪੜ੍ਹਾਉਣ ਦਾ ਜਾਂ ਫਿਰ ਜੇਕਰ ਕਈ ਵਾਰ ਸਕੂਲਾਂ ਵਿੱਚ ਵੀ ਐਨੀ ਜ਼ਿਆਦਾ ਪੜ੍ਹਾਈ ਨਹੀਂ ਹੁੰਦੀ ਕਿਉਂਕਿ ਅੱਜ ਦੇ ਟਾਈਮ 'ਚ ਸਿਲੇਬਸ ਐਨਾ ਜ਼ਿਆਦਾ ਹੋ ਚੁੱਕਿਆ ਹੈ ਅਤੇ ਬੱਚਿਆਂ 'ਤੇ ਬਹੁਤ ਜ਼ਿਆਦਾ ਬੋਝ ਹੋ ਚੁੱਕਿਆ ਹੈ ਜੋ ਕਿ ਸਕੂਲ ਦੇ ਟਾਈਮ ਵਿੱਚ ਪੂਰਾ ਨਹੀਂ ਕੀਤਾ ਜਾ ਸਕਦਾ ਇਸ ਲਈ ਸਾਨੂੰ ਕਈ ਵਾਰ ਪੇਰੈਂਟਸ ਨੂੰ ਬੱਚਿਆਂ ਨੂੰ ਪ੍ਰਾਈਵੇਟ ਟਿਊਸ਼ਨਸ ਜਾਂ ਪ੍ਰਾਈਵੇਟ ਕਲਾਸਾਂ ਦੇਣੀਆਂ ਪੈਂਦੀਆਂ ਹਨ ਕਿਉਂਕਿ ਅੱਜ ਦੇ ਟਾਈਮ ਵਿੱਚ ਐਨਾ ਜ਼ਿਆਦਾ ਕੰਪੀਟੀਸ਼ਨ ਵਧ ਚੁੱਕਿਆ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਸਾਡਾ ਬੱਚਾ ਪਹਿਲੇ ਨੰਬਰ 'ਤੇ ਆਵੇ ਅਤੇ ਉਹਦੇ ਲਈ ਸਾਨੂੰ ਐਕਸਟਰਾ ਕਲਾਸਿਜ ਲਾਉਣੀਆਂ ਹੀ ਪੈਂਦੀਆਂ ਹਨ ਚਾਹੇ ਉਹ ਬੱਚਾ ਛੋਟੀ ਕਲਾਸ 'ਚ ਹੋਵੇ ਜਾਂ ਫਿਰ ਵੱਡੀ ਕਲਾਸ 'ਚ ਕਿਉਂਕਿ ਫਸਟ ਕਲਾਸ ਤੋਂ ਹੀ ਜਿਹੜਾ ਕੰਪੀਟੀਸ਼ਨ ਹੈ ਉਹ ਬਹੁਤ ਵੱਧ ਚੁੱਕਿਆ ਹੈ ਅਤੇ ਹਰ ਕੋਈ ਪੇਰੈਂਟਸ ਇਹੀ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਅੱਵਲ ਨੰਬਰ 'ਤੇ ਲੈ ਕੇ ਆਈਏ ਅਤੇ ਅੱਜ ਦੇ ਟਾਈਮ ਵਿੱਚ ਹਰ ਕੋਲ ਇੱਕ ਜਾਂ ਦੋ ਬੱਚੇ ਹੀ ਹੁੰਦੇ ਹਨ ਅਤੇ ਉਹ ਆਪਣੀ ਪੂਰੀ ਜ਼ਿੰਦਗੀ ਦੇ ਸਾਰੇ ਪੈਸਾ ਕੁਛ ਵੀ ਹੈ ਉਹ ਆਪਣੇ ਬੱਚੇ 'ਤੇ ਲਾਉਣਾ ਜ਼ਿਆਦਾ ਪ੍ਰੈਫਰ ਕਰਦੇ ਹਨ ਇਸ ਲਈ ਉਹਨਾਂ ਨੂੰ ਕੋਈ ਪ੍ਰਾਈਵੇਟ ਕਲਾਸ ਜਾਂ ਟਿਊਸ਼ਨ ਲਾਉਣ ਵਿੱਚ ਕੋਈ ਵੀ ਉਹ ਮਨ੍ਹਾ ਨਹੀਂ ਕਰਦੇ ਅਤੇ ਉਹ ਲਾਉਣ ਲਈ ਤਿਆਰ ਹੋ ਜਾਂਦੇ ਆ